ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਪਿਛਲੇ ਜ਼ਮਾਨੇ 'ਚ ਜੇ ਅੱਜ ਦੇ ਜ਼ਮਾਨੇ 'ਚ ਬਹੁਤ ਹੀ ਫਰਕ ਆ ਗਿਆ ਈਵਨ ਕਿ ਜੋ ਟੈਕਨੋਲੋਜੀ ਆ ਉਹ ਵੀ ਬਹੁਤ ਵੱਧ ਗਈ ਹੈ ਅੱਜ ਕੱਲ੍ਹ ਸਾਰਾ ਕੁਝ ਕੰਮ ਡਿਜੀਟਲੀ ਔਨਲਾਈਨ ਅਤੇ ਸ ਸਭੀ ਨੂੰ ਈਜ਼ੀ ਵਰਤੋਂ ਈਜੀ ਸਾਰਿਆਂ ਦੀ ਈਜ਼ੀ ਵਰਤੋਂ ਲਈ ਬਹੁਤ ਕੁਝ ਬਣ ਗਿਆ ਹੈ ਤੁਸੀਂ ਦੇਖ ਸਕਦੇ ਹੋ ਪਹਿਲੇ ਜ਼ਮਾਨੇ ਵਿੱਚ ਲੋਕ ਖੂਹ 'ਚੋਂ ਪਾਣੀ ਕੱਢਦੇ ਹਨ ਉਹ ਬਾਲਟੀ ਨਾਲ ਰੱਸੀ ਪਾ ਕੇ ਅਤੇ ਬਾਲਟੀ ਨਾਲ ਪਾਣੀ ਖਿੱਚਦੇ ਹਨ ਪਹਿਲੇ ਜ਼ਮਾਨੇ ਵਿੱਚ ਔਰਤਾਂ ਅਤੇ ਮਰਦ ਅਤੇ ਬੱਚੇ ਇੱਦਾਂ ਹੀ ਪਾਣੀ ਕੱਢਦੇ ਹਨ ਅਤੇ ਅੱਜ ਦੇ ਜ਼ਮਾਨੇ 'ਚ ਬਹੁਤ ਫਰਕ ਆ ਗਿਆ ਆ ਕਿ ਅੱਜ ਦੇ ਜ਼ਮਾਨੇ 'ਚ ਲੋਕਾਂ ਘਰ ਮੋਟਰਾਂ ਲੱਗੀਆਂ ਹਨ ਜੋ ਇਲੈਕਟ੍ਰੀਸਿਟੀ ਦੀ ਵਰਤੋਂ ਕਰਦੇ ਹਨ ਜੋ ਇਲੈਕਟ੍ਰੀਸਿਟੀ ਦੀ ਵਰਤੋਂ ਵਾਸਤੇ ਵੀ ਯੂਜ ਹੁੰਦੇ ਹਨ ਅਤੇ ਅਸੀਂ ਵੇਖ ਸਕਦੇ ਹਾਂ ਕਿ ਅੱਜ ਦੇ ਜ਼ਮਾਨੇ 'ਚ ਇਹ ਟੈਕਨੋਲੋਜੀ ਬਹੁਤ ਹੀ ਈਜੀ ਹੋ ਗਈ ਹੈ ਲੋਕਾਂ ਲਈ ਉਹਨਾਂ ਨੂੰ ਦਰ ਦਰ ਜਾ ਕੇ ਖੂਹ ਨਹੀਂ ਕੱਢ ਖੂਹ 'ਚੋਂ ਪਾਣੀ ਨਹੀਂ ਕੱਢਣਾ ਪੈਂਦਾ ਪਿਛਲੇ ਜ਼ਮਾਨੇ 'ਚ ਲੋਕ ਖੂਹ 'ਚੋਂ ਹੀ ਪਾਣੀ ਕੱਢਦੇ ਹਨ ਅਤੇ ਇਸ ਜ਼ਮਾਨੇ 'ਚ ਲੋਕਾਂ ਲਈ ਕਾਫੀ ਵਧੀਆ ਹੋ ਗਿਆ ਏ ਕਿ ਉਹਨਾਂ ਨੂੰ ਖੂਹ 'ਚੋਂ ਪਾਣੀ ਕੱਢਣਾ ਨਹੀਂ ਜਾਣਾ ਹੁੰਦਾ ਅਤੇ ਸ਼ਹਿਰਾਂ ਵਿੱਚ ਵੱਖ ਵੱਖ ਘਰਾਂ 'ਚ ਮੋਟਰਾਂ ਲੱਗੀਆਂ ਹਨ ਅਤੇ ਕਈ ਲੋਕਾਂ ਨੇ ਥੱਲੇ ਟੈਂਕ ਵੀ ਪਾਏ ਹੋਏ ਹਨ ਕਿ ਜਿਵੇਂ ਕਿ ਇਲੈਕਟ੍ਰੀਸਿਟੀ ਬੰਦ ਹੋ ਜੇ ਜਾਂ ਉਹ ਨਾ ਆਏ ਅਤੇ ਉਹ ਟੈਂਕ 'ਚੋਂ ਪਾਣੀ ਚੜ੍ਹਾ ਕੇ ਮੋਟਰ ਰਾਹੀਂ ਉਹ ਉਸ ਪਾਣੀ ਦੀ ਵਰਤੋਂ ਕਰ ਸਕਦੇ ਹਨ ਅਤੇ ਕਈ ਲੋਕ ਇਹ ਜੋ ਟੈਂਕ ਬਣਾਏ ਹਨ ਘਰਾਂ 'ਚ ਉਹ ਉਹਨਾਂ ਲਈ ਬਹੁਤ ਹੀ ਵਧੀਆ ਅਤੇ ਯੂਜਫੁੱਲ ਹਨ ਅਤੇ ਅਸੀਂ ਕਹਿ ਸਕਦੇ ਹਾਂ ਕਿ ਪਿਛਲੇ ਜ਼ਮਾਨੇ 'ਚ ਲੋਕ ਖੂਹਾਂ 'ਚੋਂ ਪਾਣੀ ਕੱਢਦੇ ਹਨ ਅਤੇ ਅੱਜ ਕੱਲ੍ਹ ਲੋਕ ਲੋਕਾਂ ਦੇ ਘਰਾਂ ਵਿੱਚ ਇਲੈਕਟ੍ਰੀਸਿਟੀ ਮੋਟਰ ਸਭ ਕੁਝ ਲੱਗ ਗਏ ਹਨ